ਮੈਂ ਨਰਸਿੰਗ ਸਟੂਡੈਂਟ ਹਾਂ ਮੈਂ ਹੋਸਪਿਟ ਹੌਸਪੀਟਲ ਵਿੱਚ ਡਿਊਟੀ ਕਰਦੀ ਹਾਂ ਅਤੇ ਸਾਨੂੰ ਹੌਸਪੀਟਲ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਈ ਵਾਰ ਪੇਸ਼ੈਂਟ ਸਾਨੂੰ ਗੁੱਸੇ ਵਿੱਚ ਬੋਲਦਾ ਹੈ ਅਤੇ ਅਸੀਂ ਉਸ ਨੂੰ ਫਿਰ ਵੀ ਪਿਆਰ ਨਾਲ ਸਮਝਾਉਂਦੇ ਹਾਂ ਜੇਕਰ ਪੇਸ਼ੈਂਟ ਸਾਡੀ ਗੱਲ ਨਾ ਸਮਝੇ ਅਸੀਂ ਫਿਰ ਇਸ ਅਸੀਂ ਫਿਰ ਇਸ ਗ ਇਹ ਗੱਲ ਡੋਕਟਰ ਨੂੰ ਦੱਸਦੇ ਹਾਂ ਅਤੇ ਡੋਕਟਰ ਪੇਸ਼ੈਂਟ ਨੂੰ ਸਮਝਾ ਦਿੰਦਾ ਹੈ